ਕਿਸਾਨਾਂ ਦੀ ਖੁਦਕੁਸ਼ੀ ਤੋਂ ਬਚਾਉਣ ਲਈ ਸਾਡੇ ਇਲਾਕੇ ਵਿੱਚ ਹੈਲਪਲਾਈਨ ਨਹੀਂ ਹੁੰਦੀ ਕਿਉਂਕਿ ਸਾਡੇ ਇਲਾਕੇ ਵਿੱਚ ਸਿਰਫ਼ ਥਾਣਾ ਹੁੰਦਾ ਹੈ ਥਾਣੇ 'ਤੇ ਇਤਲਾਹ ਦਿੱਤੀ ਜਾਂਦੀ ਹੈ ਅਤੇ ਉੱਥੋਂ ਪੁਲਿਸ ਮੁਲਾਜ਼ਮ ਆਉਂਦੇ ਹਨ ਅਤੇ ਉਹ ਕਿਸਾਨਾਂ ਨੂੰ ਬਚਾਉਂਦੇ ਹਨ ਜਿਵੇਂ ਖੇਤੀਬਾੜੀ ਵਿਭਾਗ ਤੋਂ ਮੁਲਾਜ਼ਮ ਆਉਂਦੇ ਹਨ ਅਤੇ ਕਿਸਾਨਾਂ ਨੂੰ ਕਈ ਸਕੀਮਾਂ ਦੱਸਦੇ ਹਨ ਜਿਵੇਂ ਸਾਡੇ ਪਿੰਡ ਵਿੱਚ ਆ ਕੇ ਉਹ ਕੈਂਪ ਲਗਾਉਂਦੇ ਹਨ ਸਾਨੂੰ ਕਹਿੰਦੇ ਆ ਤੁਸੀਂ ਖੇਤੀ ਇਸ ਤਰ੍ਹਾਂ ਬਿਜਾਈ ਕਰੋ ਉਹ ਫਿਰ ਬਿਜਾਈ ਕਰਨ ਤੋਂ ਬਾਅਦ ਸਾਨੂੰ ਦਵਾਈਆਂ ਬਾਰੇ ਦੱਸ ਦਿੰਦੇ ਆ ਆਹ ਦਵਾਈ ਇਸ ਤਰ੍ਹਾਂ ਵਰਤੀ ਜਾਂਦੀ ਆ ਆਹ ਦਵਾਈ ਇਸ ਤਰ੍ਹਾਂ ਵਰਤੀ ਜਾਂਦੀ ਆ ਕਈ ਇਹੋ ਜਿਹੇ ਕਿਸਾਨ ਹੁੰਦੇ ਹਨ ਜਿਵੇਂ ਪਰਿਵਾਰ ਔਖਾ ਹੋ ਜਾਂਦਾ ਹੈ ਕਈਆਂ ਕਿਸਾਨਾਂ ਨੇ ਕਾਫ਼ੀ ਕਰਜ਼ਾ ਲਿਆ ਹੁੰਦਾ ਹੈ ਅਤੇ ਉਹ ਕਰਜ਼ੇ ਤੋਂ ਤੰਗ ਆ ਕੇ ਅਤੇ ਆਪਣਾ ਆਪ ਖ਼ਤਮ ਕਰ ਲੈਂਦੇ ਹਨ ਅਤੇ ਉਹਨਾਂ ਦੇ ਪਰਿਵਾਰ ਬਹੁਤ ਤੰਗ ਹੁੰਦਾ ਹੈ ਇਸ ਲੀਏ ਮੈਂ ਸਰਕਾਰ ਨੂੰ ਇਹ ਹੀ ਬੇਨਤੀ ਕਰਦਾ ਹਾਂ ਵੀ ਕਿਸੇ ਵੀ ਕਿਸਾਨ ਨੂੰ ਵਧੀਆ ਤਰੀਕੇ ਨਾਲ ਉਹਦੀ ਵਧੀਆ ਤਰੀਕੇ ਦੇ ਨਾਲ ਉਹਨੂੰ ਕਿਹਾ ਜਾਵੇ ਤਾਂ ਉਹ ਆਪਣਾ ਫਾਹਾ ਲੈਣ ਤੋਂ ਤੰਗ ਨਾ ਹੋਵੇ ਅਤੇ ਆਪਣੇ ਪਰਿਵਾਰ ਦੇ ਵਿੱਚ ਸੁ ਸੁਖੀ ਰਹਿ ਸਕਦਾ ਹੈ